ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਉੱਥੋਂ ਈ ਬੋਲਦੇ ਬੋਲਦੇ ਹਾਂ ਹਾਂਜੀ ਦੱਸੋ ਅਸੀਂ ਕੀ ਸਹਾਇਤਾ ਕਰ ਸਕਦੇ ਹਾਂ ਤੁਹਾਡੀ ਅੱਛਾ ਜੀ ਅੱਛਾ ਜੀ ਅੱਛਾ ਜੀ ਸੋਨੇ ਦਾ ਜਿੱਦਾਂ ਕੀ ਮੈਮ ਅ ਜੇ ਇੱਕ ਤੋਲਾ ਲਈਏ ਤਾਂ ਪੰਜਾਹ ਕੁ ਹਜ਼ਾਰ ਦਾ ਪਚਵੰਜਾ ਦਾ ਹੈ ਨਾ ਤਾਂ ਤੁਸੀਂ ਆਪਣੇ ਹਿਸਾਬ ਨਾਲ ਜਿੰਨੇ ਦੀ ਤੁਸੀਂ ਕਹੋਗੇ ਜਿੰਨੇ ਕੈਰਿਟ ਦੀ ਬਣਾਉਣੀ ਆ ਉਸ ਹਿਸਾਬ ਨਾਲ ਅਸੀਂ ਬਣਾ ਦਾਂਗੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕਿੱਦਣ ਆਊਂਗੇ ਤੁਸੀਂ ਮੈਮ ਠੀਕ ਹੈ ਜੀ ਠੀਕ ਹੈ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਅੱਛਾ ਜੀ ਹਾਂਜੀ ਕੋਈ ਨਹੀਂ ਜੀ ਮੈਂ ਨੋਟ ਕਰੀ ਜਾਂਦੀ ਨਾਲ ਦੀ ਨਾਲ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕੋਈ ਨਾ ਜ਼ਰੂਰ ਆਇਓ ਮੈਂ ਸਾਰੇ ਜਿਹੜੀਆਂ ਚੀਜ਼ਾਂ ਤੁਸੀਂ ਮੈਨੂੰ ਨੋਟ ਕਰਾਈਆ ਨੇ ਮੈਂ ਬਣਾ ਦੂੰਗੀ ਬਾਕੀ ਤੁਸੀਂ ਮੈਨੂੰ ਡਿਜ਼ਾਇਨ ਦੇਖਣੇ ਹੋਣਗੇ ਪਰਸੋਂ ਆਣ ਕੇ ਦੇਖ ਲਿਓ ਅਤੇ ਫਿਰ ਉਦੋਂ ਹੀ ਪੇਮੈਂਟ ਕਰ ਲਾਂਗੇ ਠੀਕ ਹੈ ਜੀ ਓ ਓਕੇ ਜੀ ਓਕੇ